ਆਮ ਤੌਰ 'ਤੇ ਮੈਂ ਕੱਪੜੇ ਜਿਹੜੇ ਆ ਗਰਮ ਪਾਣੀ ਨਾਲ ਧੋਣੀ ਹਾਂ ਠੀਕ ਹੈ ਜਿਹੜੇ ਵਿਆਹ ਸ਼ਾਦੀਆਂ ਵਾਲੇ ਕੱਪੜੇ ਹੁੰਦੇ ਆ ਜਿਹਨਾਂ ਦੇ ਉੱਤੇ ਸਿੱਪੀਆਂ ਵਗੈਰਾ ਦਾ ਵਰਕ ਕੀਤਾ ਹੁੰਦਾ ਆ ਠੀਕ ਹੈ ਜਿੱਦਾਂ ਕੋਈ ਮਤਲਬ ਪਿਓ ਪਿਓਰ ਵਗੈਰਾ ਦੇ ਕੱਪੜੇ ਹੁੰਦੇ ਆ ਠੀਕ ਆ ਉਹ ਮੈਂ ਗਰਮ ਪਾਣੀ ਨਾਲ ਧੋ ਕੇ ਠੀਕ ਹੈ ਉਹਨਾਂ ਨੂੰ ਮੈਂ ਮਸ਼ੀਨ 'ਚ ਸੁਕਾਉਂਦੀ ਨਹੀਂ ਆ ਕਿਉਂਕਿ ਉਹਦੇ ਨਾਲ ਮਸ਼ੀਨ ਵੀ ਖਰਾਬ ਹੋ ਸਕਦੀ ਹੈ ਠੀਕ ਹੈ ਅਤੇ ਇਸ ਲਈ ਉਹਨਾਂ ਨੂੰ ਮੈਂ ਗਰਮ ਪਾਣੀ ਨਾਲ ਧੋ ਕੇ ਇੱਦਾਂ ਹੀ ਸੁਕਣੇ ਪਾ ਦਿੰਦੀ ਹਾਂ ਜੋ ਅੰਦਰ ਘਰ ਦੇ ਵਿੱਚ ਤਾਰਾਂ ਲੱਗੀਆਂ ਉਹਨਾਂ 'ਤੇ ਜੇਕਰ ਮੈਂ ਕੱਪੜੇ ਸੁਕਾਉਣੇ ਆ ਮਤਲਬ ਕਿ ਜੇਕਰ ਮੌਸਮ ਬਾਹਰ ਮੀਂਹ ਵਾਲਾ ਹੋਇਆ ਉਹ ਹੋ ਹੁੰਦਾ ਆ ਤਾਂ ਫਿਰ ਉਹਨਾਂ ਨੂੰ ਮੈਂ ਗਰਮ ਪਾਣੀ ਨਾਲ ਧੋ ਕੇ ਮਸ਼ੀਨ ਵਿੱਚ ਸੁਕਾ ਕੇ ਫਿਰ ਉਹ ਤੋਂ ਬਾਅਦ ਪਾਉਂਦੀ ਹਾਂ ਦੂਸਰੇ ਕੱਪੜੇ